ਦੋ ਜਨਵਰੀ ਇੱਕ ਨੌਂ ਨੌਂ ਸੱਤ ਚਾਰ ਮਾਰਚ ਇੱਕ ਨੌਂ ਨੌਂ ਅੱਠ ਤਿੰਨ ਫਰਬਰੀ ਦੋ ਜੀਰੋ ਜੀਰੋ ਚਾਰ ਦੋ ਮਾਰਚ ਜੀਰੋ ਜੀਰੋ ਛੇ ਚਾਰ ਜੂਨ ਦੋ ਜੀਰੋ ਜੀਰੋ ਇੱਕ